ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਬਹੁਤ ਫਰਕ ਹੈ ਮੈਨੂੰ ਜ਼ਿਆਦਾ ਪੁਰਾਣੇ ਗੀਤ ਪਸੰਦ ਨੇ ਕਿਉਂਕਿ ਉਹਨਾਂ ਗੀਤਾਂ ਵਿੱਚ ਅੱਜ ਦੇ ਮੁਕਾਬਲੇ ਜ਼ਿਆਦਾ ਸਾਦਗੀ ਅਤੇ ਸਕੂਨ ਹੁੰਦਾ ਹੈ ਜੋ ਅੱਜ ਦੇ ਗੀਤਾਂ ਵਿੱਚ ਘੱਟ ਸੁਣਨ ਨੂੰ ਮਿਲਦਾ ਹੈ ਇਹ ਗੀਤ ਅੱਜ ਕੱਲ੍ਹ ਦੇ ਲ ਇਹ ਗੀਤ ਪੁਰਾਣੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਹੁੰਦੇ ਸਨ ਮੈਨੂੰ ਪੁਰਾਣੇ ਸਿੰਗਰਸ ਜਿਵੇਂ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਆਸ਼ਾ ਬੋਸਲੇ ਅਨੁਰਾਧਾ ਪੋਡਵਾਲ ਕੁਮਾਰ ਸਾਹਨੂ ਸੋਨੂੰ ਨੀਗਮ ਇਸ ਤਰ੍ਹਾਂ ਦੇ ਸਿੰਗਰਸ ਬਹੁਤ ਪਸੰਦ ਸਨ ਅਤੇ ਇਹਨਾਂ ਦੇ ਗਾਏ ਹੋਏ ਇੱਕ ਇੱਕ ਗਾਣੇ ਮੇਰੇ ਦਿਲ ਨੂੰ ਬਹੁਤ ਵਧੀਆ ਲੱਗਦੇ ਸਨ ਕਿਉਂਕਿ ਇਹਨਾਂ ਦੀ ਆਵਾਜ਼ ਬਹੁਤ ਹੀ ਸੋਹਣੀ ਅਤੇ ਵਧੀਆ ਹੁੰਦੀ ਵਧੀਆ ਸੀ ਅਤੇ ਮੈਂ ਜਿਸ ਨੂੰ ਸੁਣ ਕੇ ਬਹੁਤ ਹੀ ਖੁਸ਼ ਹੋ ਜਾਂਦੀ ਸੀ ਅਤੇ ਇਹਨਾਂ ਨੂੰ ਗਾ ਗੀਤਾਂ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਅਤੇ ਸ਼ਾਂਤੀ ਮਿਲਦੀ ਹੈ ਨਵੇਂ ਜ਼ਮਾਨੇ ਦੇ ਸੌਂਗਸ ਵੀ ਵਧੀਆ ਹਨ ਪਰ ਪੁਰਾਣੇ ਸਮੇਂ ਦੇ ਗਾਣਿਆਂ ਤੋਂ ਜ਼ਿਆਦਾ ਨਹੀਂ ਅੱਜ ਦੇ ਸੌਂਗਸ ਵਿੱਚ ਤੜਕ ਭੜਕ ਜ਼ਿਆਦਾ ਹਨ ਜੋ ਦਿਲ ਨੂੰ ਸ਼ਾਂਤੀ ਘੱਟ ਅਤੇ ਦਿਮਾਗ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਸਨ ਜਿਵੇਂ ਕਿ ਬੀਟ ਸੌਂਗ ਬੀਟ ਸੌਂਗਸ ਜ਼ਿਆਦਾ ਹਨ ਅੱਜ ਦੇ ਟਾਈਮ 'ਚ ਜਿਸ ਨੂੰ ਸੁਣ ਕੇ ਸ਼ਾਂਤੀ ਨਹੀਂ ਮਿਲਦੀ ਮੈਨੂੰ ਪਸੰਦ ਨਹੀਂ ਇਸ ਕਰਕੇ ਇਸ ਲਈ ਮੈਂ ਤੁਹਾਨੂੰ ਵੀ ਪੁਰਾਣੇ ਸੌਂਗ ਸੁਣਨ ਦੀ ਐਡਵਾਈਸ ਦਿੰਦੀ ਹਾਂ ਪੁਰਾਣੇ ਸਮੇਂ ਦੇ ਸੌਂਗ ਨਾ ਸਿਰਫ ਦਿਲ ਨੂੰ ਚੰਗੇ ਲੱਗਦੇ ਸਨ ਸਗੋਂ ਇਮੋਸ਼ਨਸ ਨੂੰ ਐਕਸਪ੍ਰੈਸ ਵੀ ਕਰਦੇ ਹਨ ਪੁਰਾਣੇ ਸਮੇਂ ਦੇ ਗੀਤ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ ਉਹਨਾਂ ਦੇ ਲੀਰਿਕਸ ਵਧੀਆ ਹੁੰਦੇ ਹਨ ਇਸ ਲਈ ਮੈਨੂੰ ਪੁਰਾਣੇ ਗੀਤ ਜ਼ਿਆਦਾ ਪਸੰਦ ਹਨ